ਭਾਰਤ ਦੇ ਫੈਸ਼ਨ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ ਪਹਿਲੇ ਲੋਕ ਸਿੱਧੇ ਸਾਦੇ ਕੱਪੜੇ ਪਹਿਨਦੇ ਸਨ ਵਿਆਹ ਵਿੱਚ ਵੀ ਕੋਈ ਬਹੁਤ ਜ਼ਿਆਦਾ ਫੈਸ਼ਨ ਨਹੀਂ ਕੀਤਾ ਜਾਂਦਾ ਸੀ ਬਹੁਤ ਜ਼ਿਆਦਾ ਭੜਕੀਲੇ ਕੱਪੜੇ ਨਹੀਂ ਪਾਏ ਜਾਂਦੇ ਸਨ ਪਰ ਹੁਣ ਤਾਂ ਹਰ ਵਿਆਹ ਵਿੱਚ ਤੁਸੀਂ ਦੇਖੋਗੇ ਕਿ ਬੱਚੇ ਜਵਾਨ ਇਵਨ ਬਜ਼ੁਰਗ ਵੀ ਫੈਸ਼ਨ ਦੇ ਕੱਪੜੇ ਪਹਿਨਣ ਲੱਗ ਪਏ ਹਨ ਪਹਿਲੇ ਜ਼ਿਆਦਾਤਰ ਲੋਕ ਸੂਟ ਪਹਿਨਦੇ ਸਨ ਸਾੜੀਆਂ ਪਹਿਨਦੇ ਸਨ ਲੇਕਿਨ ਹੁਣ ਬੱਚੇ ਪਲਾਜੋ ਲਹਿੰਗੇ ਵਗੈਰਾ ਵਗੈਰਾ ਇਸ ਤਰ੍ਹਾਂ ਦੇ ਕੱਪੜੇ ਪਾਉਣੇ ਪਸੰਦ ਕਰਦੇ ਹਨ ਗਾਰਮੈਂਟਸ ਵੀ ਗਹਿਣੇ ਵੀ ਆਰਟੀਫਿਸ਼ਅਲ ਗਹਿਣੇ ਹੀ ਵੀ ਜ਼ਿਆਦਾ ਡਰੈਸਿਸ ਨਾਲ ਮੇਲ ਖਾਂਦੇ ਪਾਉਂਦੇ ਹਨ ਪਹਿਲੇ ਤਾਂ ਸਿਰਫ ਲੋਕ ਸੋਨਾ ਹੀ ਪਾਉਂਦੇ ਸਨ ਇਸ ਤਰ੍ਹਾਂ ਫੈਸ਼ਨ ਨੇ ਪੱਛਮੀ ਫੈਸ਼ਨ ਨੇ ਵੀ ਕਾਫੀ ਪ੍ਰਭਾਵਿਤ ਕੀਤਾ ਹੈ ਲੜਕੀਆਂ ਜੀਨਜ ਅਤੇ ਛੋਟੇ ਕੱਪੜੇ ਪਾਉਂਦੇ ਪਾਉਂਦੀਆਂ ਹਨ ਜੋ ਕਿ ਸਾਡੇ ਵਰਗੇ ਬਜ਼ੁਰਗਾਂ ਨੂੰ ਜ਼ਿਆਦਾ ਪਸੰਦ ਨਹੀਂ ਆਉਂਦੇ ਅਤੇ ਫਿਰ ਅਸੀਂ ਮੈਂ ਤਾਂ ਕੱਪੜੇ ਜੋ ਪਸੰਦ ਕਰਦੀ ਹਾਂ ਮੇਰੀ ਮੇਰੀ ਚੋਆਇਸ ਤਾਂ ਇਹ ਹੈ ਕਿ ਮੈਂ ਪਟਿਆਲਾ ਸ਼ਾਹੀ ਸਲਵਾਰ ਅਤੇ ਲੰਬੀਆਂ ਕਮੀਜ਼ਾਂ ਪੰਜਾਬੀ ਜੁੱਤੀ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਜ਼ਿਆਦਾਤਰ ਇਹੋ ਜਿਹੇ ਕੱਪੜੇ ਹੀ ਪਾਉਣੇ ਪਸੰਦ ਕਰਦੀ ਹਾਂ ਪਿਓਰ ਦੇ ਦੁਪੱਟੇ ਹੋਣ ਸੋਹਣੇ ਸੋਹਣੇ ਸੂਟ ਹੋਣ ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਸਾਡੇ ਅੰਮ੍ਰਿਤਸਰ ਵਿੱਚ ਕਾਫੀ ਦੁਕਾਨਾਂ ਹਨ ਜਿਵੇਂ ਕਿ ਕੱਟੜਾ ਜੈਮਲ ਸਿੰਘ ਗੁਰੂ ਨਾਨਕ ਸਾੜੀ ਹਾਊਸ ਸ਼ਗੁਨ ਗਾਰਮੈਂਟਸ ਵਗੈਰਾ ਵਗੈਰਾ ਬਹੁਤ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਹਨ ਜਿੱਥੋਂ ਕਿ ਹਰ ਤਰ੍ਹਾਂ ਦੇ ਫੈਸ਼ਨ ਦੇ ਕੱਪੜੇ ਮਿਲ ਜਾਂਦੇ ਆ ਅਸੀਂ ਜ਼ਿਆਦਾਤਰ ਕੱਪੜੇ ਉੱਥੋਂ ਹੀ ਖਰੀਦਦੇ ਹਾਂ ਧੰਨਵਾਦ